ਮੈਂ ਸਾਈਕਲ ਦੇ ਰਾਹੀਂ ਲੇਹ ਲੇਹ ਲਦਾਖ ਜਾਣਾ ਚਾਹੁੰਦਾ ਹਾਂ ਕਿਉਂਕਿ ਇਹ ਮੇਰਾ ਪੈਸ਼ਨ ਆ ਅਤੇ ਮੇਰਾ ਬੜੀ ਦੇਰ ਦਾ ਬਚਪਨ ਦਾ ਖੁਆਬ ਆ ਕਿ ਮੈਂ ਸਾਈਕਲ 'ਤੇ ਲਦਾਖ ਜਾਵਾਂ ਮੈਂ ਇੱਕ ਵਾਰ ਟਰਾਈ ਵੀ ਕੀਤੀ ਸੀ ਪਰ ਘਰ ਦੀਆਂ ਜਿੰਮੇਦਾਰੀਆਂ ਕਾਰਣ ਮੈਂ ਜਾ ਨਹੀਂ ਸਕਿਆ ਹੁਣ ਮੈਂ ਅਗਲੇ ਮਹੀਨੇ ਛੁੱਟੀਆਂ ਪੈ ਜਾਣੀਆਂ ਅਤੇ ਛੁੱਟੀਆਂ ਦੇ ਵਿੱਚ ਮੈਂ ਲਦਾਖ ਜਾਣਾ ਆ ਅਤੇ ਸਾਈਕਲ 'ਤੇ ਇਹਦੇ ਲਈ ਮੈਂ ਪਹਿਲੇ ਤਿਆਰੀ ਕਰ ਚੁੱਕਾ ਹਾਂ ਸਾਈਕਲ ਆਪਣਾ ਲਿਸ਼ਕਾ ਚੁੱਕਾ ਅਤੇ ਬਾਕੀ ਦੇ ਸਾਰੇ ਸਮਾਨ ਜਿਹੜੇ ਰਸਤੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੋਈ ਦਿੱਕਤ ਨਾ ਆਵੇ ਉਹਦੇ ਲਈ ਮੈਂ ਸਾਰੀ ਤਿਆਰੀ ਕਰ ਚੁੱਕਾ ਅਤੇ ਇਹਦੇ ਲਈ ਇਹਦੇ ਮੇਰੇ ਨਾਲ ਜਾਣ ਨੂੰ ਮੇਰੇ ਦੋ ਦੋਸਤ ਵੀ ਰਾਜ਼ੀ ਹੋ ਗਏ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਸਾਈਕਲ 'ਤੇ ਚੱਲਾਂਗੇ ਅਤੇ ਅਸੀਂ ਪਹਿਲਾ ਸਟੇਅ ਕਰਾਂਗੇ ਜਲੰਧਰ ਫਿਰ ਕਰਾਂਗੇ ਰਸਤੇ ਵਿੱਚ ਅਸੀਂ ਚਾਰ ਪੰਜ ਸਟੇਅ ਰੱਖੇ ਨੇ ਤਾਂ ਕਿ ਅਸੀਂ ਆਰਾਮ ਨਾਲ ਉੱਥੇ ਪਹੁੰਚ ਸਕੀਏ ਸਾਨੂੰ ਕੋਈ ਦਿੱਕਤ ਨਾ ਹੋਵੇ